ਸਤਿ ਸ਼੍ਰੀ ਅਕਾਲ ਜੀ ਅੱਜ ਮੈਂ ਤੁਹਾਡੇ ਨਾਲ ਔਨਲਾਈਨ ਸ਼ੋਪਿੰਗ ਰਿਲੇਟਡ ਆਪਣਾ ਇੱਕ ਐਕਸਪੀਰੀਅੰਸ ਸ਼ੋ ਸ਼ੇਅਰ ਕਰਨਾ ਚਾਹੁੰਦਾ ਆਪਾਂ ਅੱਜ ਕੱਲ੍ਹ ਸਾਰੀਆਂ ਹੀ ਚੀਜ਼ਾਂ ਔਨਲਾਈਨ ਸ਼ੋਪਿੰਗ ਕਰਦੇ ਹਾਂ ਜਿਵੇਂ ਕਿ ਘਰ ਦੀਆਂ ਜ਼ਰੂਰਤ ਦਾ ਸਮਾਨ ਹੈ ਆਪਾਂ ਔਨਲਾਈਨ ਇਹੀ ਮੰਗਵਾਉਂਦੇ ਹਾਂ ਅੱਜ ਕੱਲ੍ਹ ਕਿਉਂਕਿ ਇਸ ਨਾਲ ਇੱਕ ਤਾਂ ਸਮੇਂ ਦੀ ਬੱਚਤ ਹੁੰਦੀ ਆ ਉਤ ਉਲਟਾ ਆਪਾਂ ਨੂੰ ਪੈਸੇ ਵੀ ਬੱਚਤ ਹੁੰਦੀ ਹੈ ਅਤੇ ਇਸ ਤਰ੍ਹਾਂ ਮੈਨੇ ਇੱਕ ਮੋਬਾਇਲ ਫੋਨ ਓਰਡਰ ਕੀਤਾ ਸੀਗਾ ਔਨਲਾਈਨ ਹੀ ਚਲੋ ਸਾਈਡ ਦਾ ਤਾਂ ਮੈਂ ਨਾਮ ਨਹੀਂ ਦੱਸਣਾ ਚਾਹੁੰਦਾ ਅਤੇ ਮੈਨੇ ਜਦੋਂ ਇਹ ਮੋਬਾਈਲ ਫੋਨ ਓਰਡਰ ਕੀਤਾ ਤਾਂ ਇਹ 'ਤੇ ਸਾਰੀਆਂ ਜੋ ਫਸਿਲਟੀਜ਼ ਨੇ ਕੰਪ ਮੋਬਾਈਲ ਵਿੱਚ ਜੋ ਫੀਚਰ ਦਿੱਤੇ ਗਏ ਸੀ ਉਹ ਸਾਰਾ ਦੇਖ ਪਰਖ ਹੀ ਮੈਨੇ ਮੋਬਾਇਲ ਫੋਨ ਨੂੰ ਓਰਡਰ ਕੀਤਾ ਸੀ ਬਟ ਜਦੋਂ ਇਹ ਮੋਬਾਇਲ ਫੋਨ ਮੇਰੇ ਕੋਲ ਆਇਆ ਅਤੇ ਮੈਨੇ ਇਸ ਯੂਜ ਕਰਕੇ ਦੇਖਿਆ ਮੈਨੂੰ ਸ਼ੁਰੂਆਤੀ ਦੋ ਤਿੰਨ ਦਿਨਾਂ ਦੇ ਵਿੱਚ ਇਸ ਨੂੰ ਜੋ ਯੂਜ ਕੀਤਾ ਤਾਂ ਮੈਨੂੰ ਇਸ ਵਿੱਚ ਪਤਾ ਲੱਗਿਆ ਕਿ ਇਸਦਾ ਜੋ ਪ੍ਰੋਸੈਸਰ ਹੈ ਉਹ ਬਹੁਤ ਸਲੋਅ ਸੀ ਪ੍ਰੋਸੈਸਰ ਸਲੋਅ ਸੀ ਅਤੇ ਨਾਲ ਦੀ ਨਾਲ ਜੋ ਇਸਦਾ ਚਾਰਜਿੰਗ ਪੁਆਇੰਟ ਸੀਗਾ ਉਹ ਸੀ ਟੈਪ ਦੀ ਜਗ੍ਹਾ ਡੀ ਟਾਈਪ ਸੀਗਾ ਅਤੇ ਚਾਰਜਿੰਗ ਜਿਸ ਕਰਕੇ ਬਹੁਤ ਸਲੋਅ ਹੋ ਰਹੀ ਸੀ ਅਤੇ ਆਪਣਾ ਇਸ 'ਚ ਕੈਮਰਾ ਕੁਆਲਿਟੀ ਸੀ ਕੈਮਰਾ ਕੁਆਲਿਟੀ ਵੀ ਬਹੁਤ ਲੋਅ ਸੀ ਜਦੋਂ ਮੈਨੇ ਇਸ ਜਦੋਂ ਮੈਨੇ ਮੋਬਾਇਲ ਫੋਨ ਖਰੀਦਿਆ ਸੀ ਉਦੋਂ ਕੰਪਨੀ ਵੱਲੋਂ ਇਹ ਕਿਹਾ ਗਿਆ ਸੀ ਤੁਸੀਂ ਇਹਨੂੰ ਪੰਦ ਯੂਜ ਕਰਨੇ ਪੰਦਰ੍ਹਾਂ ਦਿਨ ਦਾ ਤੁਹਾਡੇ ਕੋਲ ਪੀਰੀਅਡ ਆ ਯੂਜ ਕਰੋ ਜੇ ਤੁਹਾਨੂੰ ਨਹੀਂ ਵਧੀਆ ਲੱਗਦਾ ਤਾਂ ਤੁਸੀਂ ਇਸਨੂੰ ਵਾਪਸ ਕਰ ਸਕਦੇ ਬਟ ਜਦੋਂ ਇਸ ਨੂੰ ਵਾਪਸ ਕਰਨ ਲਈ ਮੈਨੇ ਕੰਪਨੀ ਨੂੰ ਫੋਨ ਕੀਤਾ ਤਾਂ ਕੰਪਨੀ ਨੇ ਮੈਨੂੰ ਇਹ ਐਕਸਕਿਊਜ ਦਿੱਤਾ ਕਿ ਸਰ ਤੁਸੀਂ ਟਾਈਮ ਪੀਰੀਅਡ ਲੰਘਾ ਚੁੱਕੇ ਹੋ ਹੁਣ ਇਹ ਤੁਸੀਂ ਵਾਪਸ ਨਹੀਂ ਕਰ ਸਕਦੇ ਇਸ ਵਿੱਚ ਨਾਲ ਦੀ ਨਾਲ ਇੱਕ ਇਸ਼ੂ ਹੋਰ ਵੀ ਆਇਆ ਮੈਨੂੰ ਕਿ ਇਸਦਾ ਜੋ ਸਪੀਕਰ ਸੀ ਉਹ ਵੀ ਖਰਾਬ ਸੀ ਕਹਿੰਦੇ ਮੈਨੇ ਕੰਪਨੀ ਨੂੰ ਕਹਿੰਦੇ ਇਹਦਾ ਸਪੀਕਰ ਵੀ ਖਰਾਬ ਹੈ ਕੰਪਨੀ ਕਹਿੰਦੇ ਵੀ ਤੁਸੀਂ ਹੁਣ ਇਸ ਨੂੰ ਕਸਟਮਰ ਕੇਅਰ ਵਿੱਚ ਹੀ ਦਿਖਾ ਸਕਦੇ ਹੋ ਬਟ ਜਦੋਂ ਕਸਟਮਰ ਕੇਅਰ ਵਿੱਚ ਮੈਂ ਗਿਆ ਉਹਨਾਂ ਨੇ ਜਦੋਂ ਮੈਨੂੰ ਇਸਦਾ ਕੋਈ ਵੀ ਸਲਿਊਸ਼ਨ ਨਹੀਂ ਦਿੱਤਾ ਨਾ ਹੀ ਮੈਨੂੰ ਕੰਪਨੀ ਵੱਲੋਂ ਸਲਿਊਸ਼ਨ ਦਿੱਤਾ ਗਿਆ ਨਾ ਹੀ ਜਿੱਥੋਂ ਮੈਨੇ ਸ਼ ਇਸਨੂੰ ਬਾਏ ਕੀਤਾ ਸੀ ਉਹਨਾਂ ਨੇ ਸਲਿਊਸ਼ਨ ਦਿੱਤਾ ਦੋਵਾਂ ਜਗ੍ਹਾ ਤੋਂ ਮੈਨੂੰ ਸਲਿਊਸ਼ਨ ਕੋਈ ਪ੍ਰਾਪਤ ਨਹੀਂ ਹੋਇਆ ਇਸ ਕਰਕੇ ਮੋਬਾਈਲ ਫੋਨ ਮੈਨੂੰ ਇੱਕ ਤਰ੍ਹਾਂ ਦਾ ਮੇਰਾ ਬੈਡ ਐਕਸਪੀਰੀਅੰਸ ਹੀ ਰਿਹਾ ਇਸ ਇਸਦੇ ਨਾਲ ਧੰਨਵਾਦ